ਸਾਡੇ ਰਾਜ ਵਿੱਚ ਗੁਰੂ ਪ੍ਰਮੁੱਖ ਧਾਰਮਿਕ ਆਗੂ ਜਾਂ ਸਖਸ਼ੀਅਤਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਜਿਵੇਂ ਕਿ ਪੰਜਾਬ ਰਾਜ ਵਿੱਚ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਜਿੰਨਾ ਤੁਹਾਨੂੰ ਕਾਫੁਕ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਆਪਾਂ ਦੇ ਉਹਨਾਂ ਨੇ ਮਤਲਬ ਸਿਰਫ ਪੰਜਾਬ ਵਾਸਤੇ ਨਹੀਂ ਪੂਰੇ ਦੇਸ਼ ਵਾਸਤੇ ਆਪਣੇ ਪੂਰੇ ਪਰਿਵਾਰ ਦੀ ਜਾਨ ਨਿਸ਼ਾਵਰ ਕਰਤੀ ਕੋਈ ਪ੍ਰਵਾਹ ਨਹੀਂ ਕੀਤੀ ਨਾ ਨਾ ਆਪਣੇ ਮਾਤਾ ਜੀ ਦੀ ਪ੍ਰਵਾਹ ਕੀਤੀ ਨਾ ਆਪਣੇ ਬੱਚਿਆਂ ਦੀ ਪਰਵਾਹ ਕੀਤੀ ਨਾ ਪਿਤਾ ਜੀ ਦੀ ਨੇ ਪੂਰੇ ਪਰਿਵਾਰ ਦਾ ਵਿਛੋੜਾ ਸਹਿ ਲਿਆ ਉਹਨਾਂ ਨੇ ਖੁਦ ਵੀ ਮਤਲਬ ਖੁਦ ਨੂੰ ਵੀ ਕਿੰਨੀਆਂ ਉਹਨਾਂ ਨੂੰ ਦਿੱਕਤਾਂ ਆਈਆਂ ਪਰ ਝੁਕੇ ਨਹੀਂ ਉਹ ਧਰਮ ਦੇ ਖਾਤਿਰ ਅਤੇ ਧਰਮ ਨੂੰ ਲੈ ਕੇ ਪੂਰੇ ਪੱਕੇ ਸਨ ਅਤੇ ਉਹਨਾਂ ਨੇ ਮਤਲਬ ਆਪਣੇ ਬੱਚਿਆਂ ਨੂੰ ਵੀ ਕਿੰਨੀ ਵਧੀਆ ਸੀਖ ਦਿੱਤੀ ਸੀਗੀ ਕਿ ਹਾਂ ਮਤਲਬ ਧਰਮ ਧਰਮ ਦੇ ਅੱਗੇ ਆਪਾਂ ਝੁਕਣਾ ਨਹੀਂ ਜੇਕਰ ਧਰਮ ਦੀ ਜਿੱਤ ਹੋ ਰਹੀ ਹੈ ਤਾਂ ਉਹਦੀ ਜਿੱਤ ਤੁਹਾਨੂੰ ਸੁਨਿਸ਼ਚਿਤ ਕਰਨੀ ਹੈ ਇਹ ਨਹੀਂ ਕਿ ਡਰ ਕੇ ਉੱਥੋਂ ਭੱਜ ਜਾਣਾ ਜਾਂ ਝੁੱਕ ਜਾਣਾ ਤਾਂ ਜੋ ਬੱਚਿਆਂ ਨੇ ਵੀ ਉਹਨਾਂ ਨੇ ਉਹਨਾਂ ਦੇ ਬੱਚਿਆਂ ਨੇ ਵੀ ਕਾਫੀ ਕੁਝ ਵਧੀਆ ਸਿੱਖਿਆ ਅਤੇ ਉਹ ਸਭ ਦੇਖਦੇ ਹੋਏ ਮੈਂ ਇਹ ਦੇਖ ਰਿਹਾ ਕਿ ਆਉਣ ਵਾਲੀ ਪੀੜ੍ਹੀ ਨੇ ਵੀ ਕਾਫੀ ਕੁਝ ਵਧੀਆ ਸਿੱਖਿਆ ਵਾ ਵੀ ਹਾਂ ਜੇਕਰ ਸਾਡੇ ਧਰਮ ਨੂੰ ਲੈ ਕੇ ਕੋਈ ਕੁਝ ਗਲਤ ਕਹਿ ਰਿਹਾ ਵਾ ਤੁਹਾਨੂੰ ਉਹਦੇ ਖਿਲਾਫ ਲੜਨਾ ਆ ਨਾ ਕਿ ਇਹ ਨਹੀਂ ਕਿ ਝੁੱਕ ਕੇ ਰਹਿ ਜਾਣਾ ਜਾਂ ਤੁਹਾਨੂੰ ਕੋਈ ਕਿਸੇ ਧਰਮ ਵਿੱਚ ਤਬਦੀਲ ਕਰਾ ਰਿਹਾ ਤੁਹਾਨੂੰ ਨਹੀਂ ਹੋਣਾ ਜੇਕਰ ਆਪਾਂ ਕਿਸੇ ਧਰਮ ਨੂੰ ਲੈ ਕੇ ਇੱਕ ਪੱਕੇ ਆ ਤੁਹਾਨੂੰ ਉਹਨੂੰ ਲੈ ਕੇ ਪੱਕੇ ਹੋਣਾ ਚਾਹੀਦਾ ਤੁਹਾਨੂੰ ਸਾਰੇ ਧਰਮਾਂ ਨੂੰ ਮੰਨਣਾ ਚਾਹੀਦਾ ਕਿਸੇ ਨੂੰ ਵੀ ਨੀਵਾਂ ਕਿਸੇ ਨੂੰ ਉੱਚਾ ਨਹੀਂ ਸਮਝਣਾ ਚਾਹੀਦਾ ਸਾਰਿਆਂ ਨੂੰ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਹੈ